ਭਾਰਤ ਵਿੱਚ ਬਹੁਤ ਹੀ ਧਾਰਮਿਕ ਅਸਥਾਨ ਨੇ ਅਤੇ ਉਹ ਸੈਰ ਸਪਾਟੇ ਲਈ ਵੀ ਲੋਕ ਜਾਂਦੇ ਨੇ ਕਿ ਧਾਰਮਿਕ ਨਾਲ ਸੈਰ ਸਪਾਟਾ ਵੀ ਹੋ ਜਾਏਗਾ ਅਤੇ ਧਰਮ ਨਾਲ ਵੀ ਜੁੜੇ ਰਵਾਂਗੇ ਜਿਵੇਂ ਜਗਨਨਾਥ ਪੁਰੀ ਹੈ ਤਾਂ ਲੋਕ ਬਹੁਤ ਦੂਰੋਂ ਦੂਰੋਂ ਜਗਨਨਾਥ ਪੁਰੀ ਜਾਂਦੇ ਆ ਅਤੇ ਕਿਉਂਕਿ ਉਹ ਚਾਰ ਧਾਰ ਧਰਮਾਂ ਧਾਮਾਂ ਦੀ ਯਾਤਰਾ ਕਿ ਜੋ ਕਿਹਾ ਜਾਂਦਾ ਹੈ ਉਹਨਾਂ ਵਿੱਚੋਂ ਵੀ ਇੱਕ ਹੈ ਫਿਰ ਲੋਕ ਉਜੈਨ ਜਾਂਦੇ ਆ ਮਹਾਕਾਲ ਜਿਹਨੂੰ ਕਹਿੰਦੇ ਆ ਅਤੇ ਉੱਥੇ ਘੁੰਮਣ ਲਈ ਵੀ ਬੜੀ ਅੱਛੀ ਮਾਰਕੀਟ ਹੈ ਬੜਾ ਵਧੀਆ ਲੱਗਦਾ ਹੈ ਅਤੇ ਦੇਖਿਆ ਜਾਏ ਕੈਦਾਰਨਾਥ ਜਿੱਥੋਂ ਦਾ ਮੌਸਮ ਬੜਾ ਚੰਗਾ ਹੈ ਲੋਕ ਜਾਂਦੇ ਹੈ ਕੈਦਾਰਨਾਥ ਔਖਾ ਜ਼ਰੂਰ ਹੈ ਉਹਦਾ ਪੈਂਡਾ ਔਖਾ ਹੈ ਪਰ ਲੋਕ ਕੈਦਾਰਨਾਥ ਜਾਂਦੇ ਆ ਕਿ ਇੱਕ ਤਾਂ ਸੈਰ ਸਪਾਟਾ ਵੀ ਹੋ ਜਾਂਦਾ ਹੈ ਕਿਉਂਕਿ ਉਹ ਪਹਾੜਾਂ ਦੇ ਉੱਪਰ ਬਣਿਆ ਹੋਇਆ ਅਤੇ ਧਾਰਮਿਕ ਵੀ ਬਹੁਤ ਜ਼ਿਆਦਾ ਧਰਮ ਨਾਲ ਵੀ ਜੋੜਦਾ ਹੈ ਫਿਰ ਦੇਖਿਆ ਜਾਏ ਪੰਜਾਬ ਵਿੱਚ ਗੋਲਡਨ ਟੈਂਪਲ ਬੜਾ ਮਸ਼ਹੂਰ ਹੈ ਗੋਲਡਨ ਟੈਂਪਲ ਗੂਰਾ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਵਿਖੇ ਹੈ ਅਤੇ ਇੱਥੇ ਲੋਕ ਨਾਲੇ ਤਾਂ ਸੈਰ ਸਪਾਟਾ ਹੋ ਜਾਂਦਾ ਕਿਉਂਕਿ ਨਾਲ ਮੌਲ ਵੀ ਹੈਗੇ ਆ ਥੀਏਟਰਜ਼ ਵੀ ਹੈਗੇ ਆ ਅਤੇ ਨਾਲੇ ਲੋਕ ਦਰਸ਼ਨ ਕਰ ਲੈਂਦੇ ਹੈ ਧਾਰਮਿਕ ਅਸਥਾਨ 'ਤੇ ਫਿਰ ਦੇਖਿਆ ਜਾਏ ਤਾਂ ਰਾਜਸਥਾਨ 'ਚ ਸਾਲਾ ਸਰਧਾਮ ਜਿਹਨੂੰ ਕਿਹਾ ਜਾਂਦਾ ਹੈ ਸਾਲਾ ਸਰਧਾਮ ਹੈ ਹਨੂੰਮਾਨ ਜੀ ਦਾ ਮੰਦਰ ਹੈ ਜਿੱਥੇ ਫਿਰ ਲੋਕ ਸੈਰ ਸਪਾਟੇ ਵਾਸਤੇ ਵੀ ਜਾਂਦੇ ਹੈ ਅਤੇ ਧਰਮ ਨਾਲ ਜੁੜਨ ਵਾਸਤੇ ਵੀ ਜਾਂਦੇ ਹੈ ਫਿਰ ਨਾਲ ਹੀ ਥੋੜ੍ਹੀ ਦੂਰ 'ਤੇ ਖਾਟੂ ਸ਼ਾਮ ਮੰਦਰ ਹੈ ਜਿੱਥੇ ਲੋਕ ਜਾਂਦੇ ਹੈ ਦੇਖਿਆ ਜਾਏ ਤਾਂ ਜੰਮੂ ਕਸ਼ਮੀਰ ਵਿੱਚ ਵੀ ਵੈਸ਼ਨੋ ਦੇਵੀ ਦਾ ਮੰਦਰ ਹੈ ਮਾਤਾ ਵੈਸ਼ਨੋ ਦੇਵੀ ਦਾ ਮੰਦਰ ਫਿਰ ਉਹਦਾ ਪੈਂਡਾ ਜ਼ਰੂਰ ਔਖਾ ਹੈ ਪਰ ਲੋਕ ਅਗੇਨ ਕਿਉਂਕਿ ਉੱਥੇ ਬਹੁਤ ਪਹਾੜ ਵਗੈਰਾ ਹੈ ਤਾਂ ਲੋਕ ਸੈਰ ਸਪਾਟੇ ਲਈ ਵੀ ਜਾਂਦੇ ਹੈ ਥੈਂਕ ਯੂ